ਇੱਕ ਦੌੜਾਕ ਲਈ ਖੁਰਾਕ ਬਹੁਤ ਹੀ ਜ਼ਰੂਰੀ ਅੰਗ ਹੈ ਦੌੜਾਕਾਂ ਵਾਲੀ ਕਾਰਬੋਹਾਈਡ੍ਰੇਟ ਬਹੁਤ ਮਹੱਤਵਪੂਰਨ ਹਨ ਇਹ ਊਰਜਾ ਪ੍ਰਦਾਨ ਕਰਦੇ ਨੇ ਕਾਰਬੋਹਾਈਡ੍ਰੇਟ ਅਨਾਜ ਫਲ ਅਤੇ ਸਬਜ਼ੀਆਂ ਦੁੱਧ ਤੋਂ ਛ ਮਿਲਦੇ ਹਨ ਪ੍ਰੋਟੀਨ ਮਾਸਪੇਸ਼ੀਆਂ ਦੀ ਮੁਰੰਮਤ ਅਤੇ ਵਾਧੇ ਲਈ ਜ਼ਰੂਰੀ ਨੇ ਇਹ ਆਂਡਾ ਮੱਛੀ ਦਾਲਾਂ ਸਬਜ਼ੀਆਂ ਬੀਨਸ ਅਤੇ ਨਟਸ ਤੋਂ ਸ਼ਾਮਿਲ ਹੁੰਦੇ ਹਨ ਫੈਟ ਵੀ ਦੌੜਾਕਾਂ ਲਈ ਮਹੱਤਵਪੂਰਨ ਹਨ ਫੈਟ ਦੇ ਸਰੋਤਿਆਂ ਵਿੱਚ ਓਵੋਕਾਡੋ ਨਟਸ ਬੀਜਾਂ ਅਤੇ ਫਿਸ਼ ਆਇਲ ਸ਼ਾਮਿਲ ਹੁੰਦੇ ਨੇ ਵਿਟਾਮਿਨ ਲਈ ਵਿਟਾਮਿਨ ਮਿਲਨਰ ਸਰੀਰ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ ਦੌੜਨ ਲਈ ਵਿਟਾਮਿਨ ਸੀ ਵਿਟਾਮਿਨ ਡੀ ਕੈਲਸ਼ੀਅਮ ਅਲੋਆ ਪੋਟ ਹੋਣਾ ਚਾਹੀਦਾ ਦੌੜਾਕਾਂ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਖੁਰਾਕ ਕੁਛ ਇਸ ਪ੍ਰਕਾਰ ਹੈ ਸਵੇਰੇ ਛੇ ਤੋਂ ਸੱਤ ਵਜੇ ਸਵੇਰੇ ਇੱਕ ਗਲਾਸ ਪਾਣੀ ਇੱਕ ਕੱਪ ਚਾਹ ਜਾਂ ਕਾਫੀ ਦੋ ਆਂਡੇ ਇੱਕ ਕੱਪ ਤਾਜ਼ੇ ਫਲ ਅਤੇ ਨਾਸ਼ਤੇ ਸਮੇਂ ਦਸ ਤੋਂ ਗਿਆਰਾਂ ਵਜੇ ਇੱਕ ਕੱਪ ਦਹੀਂ ਇੱਕ ਕੱਪ ਫਲਾਂ ਦਾ ਰਸ ਇੱਕ ਛੋਟਾ ਪੈਕਟ ਨਟਸ ਬਦਾਮ ਜਾਂ ਅਖਰੋਟ ਹੋ ਜਾਣ ਦੁਪਹਿਰ ਵੇਲੇ ਬਾਰਾਂ ਤੋਂ ਡੇਢ ਇੱਕ ਵਜੇ ਦੇ ਵਿੱਚ ਵਿੱਚ ਇੱਕ ਪਲੇਟ ਚਾਵਲ ਇਕ ਪਲੇਟ ਸਬਜ਼ੀਆਂ ਇੱਕ ਪਲੇਟ ਚਿਕਨ ਜਾਂ ਮੱਛੀ ਇੱਕ ਕੱਪ ਸਲਾਦ ਸ਼ਾਮ ਚਾਰ ਤੋਂ ਪੰਜ ਵਜੇ ਤੱਕ ਇੱਕ ਕੱਪ ਚਾਹ ਜਾਂ ਕਾਫੀ ਇੱਕ ਛੋਟਾ ਪੈਕਟ ਬਿਸਕਿਟ ਦਾ ਇੱਕ ਕੱਪ ਫਲਾਂ ਦਾ ਰਸ ਰਾਤ ਸੱਤ ਤੋਂ ਅੱਠ ਵਜੇ ਦੇ ਵਿੱਚ ਵਿੱਚ ਇੱਕ ਪਲੇਟ ਚਾਵਲ ਇਕ ਪਲੇਟ ਸਬਜ਼ੀਆਂ ਇੱਕ ਪਲੇਟ ਚਿਕਨ ਜਾਂ ਮੱਛੀ ਜਾਂ ਇੱਕ ਕੱਪ ਦਹੀਂ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਨੌ ਤੋਂ ਦਸ ਵਜੇ ਤੱਕ ਇਕ ਗਲਾਸ ਗਰਮ ਦੁੱਧ ਇੱਕ ਛੋਟਾ ਪੈਕਟ ਨਟਸ ਇਹ ਡਾਇਟ ਦੌੜਾਕਾਂ ਲਈ ਬਹੁਤ ਹੀ ਜ਼ਰੂਰੀ ਹੈ ਜਿਸ ਨਾਲ ਸਰੀਰ ਤੰਦਰੁਸਤ ਰਹੇਗਾ ਅਤੇ ਸਿਹਤਮੰਦ ਰਹੇਗਾ ਜਿਸ ਨਾਲ ਉਹਨਾਂ ਨੂੰ ਦੌੜਨ ਵਿੱਚ ਆਸਾਨੀ ਹੋਵੇਗੀ ਅਤੇ ਸਰੀਰ ਦੀ ਟੁੱਟ ਭੱਜ ਨਹੀਂ ਹੋਵੇਗੀ ਅਤੇ ਜਿਸ ਨਾਲ ਉਹਨਾਂ ਦਾ ਸਰੀਰ ਤੰਦਰੁਸਤ ਰਹੇਗਾ ਇਸ ਨਾਲ ਉਹਨਾਂ ਦੀ ਮਾਨਸਿਕ ਤੌਰ 'ਤੇ ਵੀ ਤੰਦਰੁਸਤੀ ਬਣੀ ਰਹੇਗੀ